ਪਿਛਲੇ ਸਾਲ ਮੈਂ ਆਪਣੇ ਮੰਮਾ ਪਾਪਾ ਨਾਲ ਅਤੇ ਆਪਣੇ ਹੋਰ ਵੀ ਰਿਸ਼ਤੇਦਾਰ ਜਿੱਦਾਂ ਕਿ ਮੇਰੇ ਭੂਆ ਫੁੱਫੜ ਮਾਸੜ ਮਾਸੀ ਚਾਚੀ ਚਾਚੂ ਤਾਇਆ ਜੀ ਤਾਇਆ ਜੀ ਅਸੀਂ ਸਾਰੇ ਮਿਲ ਕੇ ਜੂਨ ਛੁੱਟੀਆਂ ਦੇ ਵਿੱਚ ਪਟਨਾ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ ਅਤੇ ਉਸਦੇ ਲਈ ਅਸੀਂ ਇੱਕ ਆਪਣੇ ਨਿੱਜੀ ਬੱਸ ਬੁੱਕ ਕਰ ਲਈ ਜਿਸਦੇ ਡਰਾਈਵਰ ਸਾਡੇ ਗਵਾਂਢ ਦੇ ਵਿੱਚ ਹੀ ਰਹਿੰਦੇ ਸਨ ਅਤੇ ਉਹਨਾਂ ਦਾ ਸੁਭਾਅ ਬਹੁਤ ਹੀ ਮਿੱਠਾ ਸੀ ਸੋ ਇਸ ਕਰਕੇ ਸਾਨੂੰ ਜਾਣ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਹੋਈ ਜਦੋਂ ਅਸੀਂ ਬੱਸ ਦੇ ਵਿੱਚ ਜਾ ਕੇ ਦੇਖਿਆ ਤਾਂ ਬੱਸ ਦਾ ਰੰਗ ਚਿੱਟਾ ਸੀ ਅਤੇ ਬੱਸ ਦੇ ਵਿੱਚ ਜਿੰਨਾਂ ਅਸੀਂ ਤੀਹ ਜਣਿਆਂ ਦੀਆਂ ਸਵਾਰੀਆਂ ਸੀ ਤਾਂ ਕਰਕੇ ਉਹਦੇ ਵਿੱਚ ਬੱਤੀ ਸੀਟਾਂ ਸਨ ਬੱਸ ਦੇ ਵਿੱਚ ਪੂਰੀਆਂ ਖਿੜਕੀਆਂ ਲੱਗੀਆਂ ਹੋਈਆਂ ਸੀ ਪੂਰੀ ਹਵਾਦਾਰ ਸੀ ਅਤੇ ਪੂਰਾ ਬਾਹਰ ਦਾ ਦ੍ਰਿਸ਼ ਬਹੁਤ ਸੋਹਣਾ ਦਿਖ ਰਿਹਾ ਸੀ ਜਦੋਂ ਹੀ ਅਸੀਂ ਆਪਣਾ ਜਾਣ ਦਾ ਸਾਰਾ ਕੰਮ ਸ਼ੁਰੂ ਕੀਤਾ ਤਾਂ ਉਸ ਦੇ ਵਿੱਚ ਰਸਤੇ ਵਿੱਚ ਰੁਕ ਕੇ ਉੱਥੇ ਚਾਹ ਪਾਣੀ ਪੀਂਦੇ ਆ ਰੋਟੀ ਖਾਂਦੇ ਇਸ ਤਰ੍ਹਾਂ ਸਾਨੂੰ ਸਭ ਨੂੰ ਇੱਕ ਆਰਾਮ ਮਿਲ ਜਾਂਦਾ ਸੀ ਅਤੇ ਡਰਾਈਵਰ ਨੂੰ ਵੀ ਇੱਕ ਬਹੁਤ ਹੀ ਆਸਾਨੀ ਨਾਲ ਸਫਰ ਜੋ ਸੀ ਹੋ ਰਿਹਾ ਸੀ ਇੰਝ ਕਰਦੇ ਕਰਾਉਂਦੇ ਅਸੀਂ ਸਾਡਾ ਪੰਦਰਾਂ ਘੰਟਿਆਂ ਦਾ ਸਫਰ ਬਹੁਤ ਹੀ ਚੰਗੇ ਤਰੀਕੇ ਨਾਲ ਲੰਘ ਗਿਆ ਅਸੀਂ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕਰਦੇ ਹੱਸਦੇ ਖੇਡਦੇ ਆਪਣੇ ਸਫਰ ਨੂੰ ਮੁਕਾਇਆ ਅਤੇ ਪੰਦਰ੍ਹਾਂ ਘੰਟਿਆਂ ਦੇ ਅੰਦਰ ਅਗਲੇ ਦਿਨ ਅਸੀਂ ਬਹੁਤ ਹੀ ਚੰਗੀ ਤਰ੍ਹਾਂ ਉੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਆਉਂਦਿਆਂ ਸਭ ਨੂੰ ਆਪਣਾ ਪ੍ਰਸ਼ਾਦ ਦਿੱਤਾ